ਮੇਰਾ ਮਨ ਪਸੰਦ ਹਵਾਲਾ ਡੇਲ ਕਾਰਨੇਗੀ ਦੀ ਕਿਤਾਬ ਹਾਓ ਟੂ ਵਿੰਨ ਫਰੈਂਡਸ ਐਂਡ ਇੰਨਫਲੁਐਂਸ ਪੀਪਲ ਦੇ ਵਿੱਚੋਂ ਹੈ ਇਹ ਹਵਾਲਾ ਇਹ ਹੈ ਕਿ ਉਸਦੇ ਵਿੱਚ ਲਿਖਿਆ ਗਿਆ ਸੀ ਕਿ ਕੋਈ ਵੀ ਦੂਸਰਾ ਆਦਮੀ ਜਾਂ ਦੂਸਰੀ ਸ਼ਖਸੀਅਤ ਤੁਹਾਡੀ ਗੱਲ ਸੁਣਨ ਵਿੱਚ ਉੰਨੀ ਦੇਰ ਤੱਕ ਇੰਟਰਸਟ ਨਹੀਂ ਦਿਖਾਏਗਾ ਜਦੋਂ ਤੱਕ ਤੁਸੀਂ ਉਹਦੇ ਬਾਰੇ ਗੱਲ ਨਹੀਂ ਕਰੋਗੇ ਜੇ ਤੁਸੀਂ ਸਿਰਫ਼ ਆਪਣੇ ਬਾਰੇ ਗੱਲ ਕਰੀ ਜਾਓਗੇ ਤਾਂ ਉਹ ਬੰਦਾ ਜਿਹੜਾ ਸਾਹਮਣੇ ਤੁਹਾਡੀ ਗੱਲ ਸੁਣ ਰਿਹਾ ਉਹ ਇੰਟਰਸਟ ਲੂਜ਼ ਕਰ ਜਾਂਦਾ ਹੈ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਹੈ ਉਸਦਾ ਇੰਟਰਸਟ ਬਣਾਓ ਜਿਸ ਤਰ੍ਹਾਂ ਕੋਈ ਬੱਚਾ ਦੁੱਧ ਨਹੀਂ ਪੀਂਦਾ ਅਤੇ ਉਹ ਬੱਚਾ ਦੁੱਧ ਨਹੀਂ ਪੀਂਦਾ ਅਤੇ ਉਹਨੂੰ ਜੇ ਤੁਸੀਂ ਕਹੋ ਨਾ ਕਿ ਦੁੱਧ ਪੀਣ ਦੇ ਨਾਲ ਤੂੰ ਸਟਰੋਂਗ ਹੋਵੇਗਾ ਤੈਨੂੰ ਜੇ ਉਹ ਕਲਾਸ ਦੇ ਵਿੱਚ ਬੱਚਾ ਬੁੱਲੀ ਕਰਦਾ ਵਾ ਤੂੰ ਉਹਨੂੰ ਉਹਦੇ ਤੋਂ ਤਾਕਤਵਰ ਹੋ ਜਾਵੇਗਾ ਤੂੰ ਉਹਨੂੰ ਮਤਲਬ ਫੇਸ ਕਰ ਸਕਦਾ ਹਾਂ ਅਤੇ ਫਿਰ ਤਾਂ ਸ਼ਾਇਦ ਸੁਣ ਲਵੇਗਾ ਕਿਉਂਕਿ ਉਹਦੇ ਇੰਟਰਸਟ ਦੀ ਗੱਲ ਹੋ ਰਹੀ ਹੈ ਪਰ ਜੇ ਤੁਸੀਂ ਕਹੋ ਕਿ ਮੈਂ ਚਾਹੁੰਦਾ ਹਾਂ ਮੈਂ ਤੇਰਾ ਫਾਦਰ ਹਾਂ ਮੈਂ ਤੇਰੀ ਮਦਰ ਹਾਂ ਮੈਂ ਤੇਰਾ ਪਿਤਾ ਹਾਂ ਕਿ ਤੂੰ ਦੁੱਧ ਪੀ ਤਾਂ ਉਹ ਕਦੇ ਵੀ ਇੰਟਰਸਟਿੰਗ ਇੰਟਰਸਟ ਨਹੀਂ ਰੱਖੇਗਾ ਇਸ ਤਰ੍ਹਾਂ ਹੀ ਮੇਰੀ ਲਾਈਫ ਦੇ ਵਿੱਚ ਇਸ ਤਰੀਕੇ ਨਾਲ ਹੈ ਕਿ ਮੈਂ ਅੱਜ ਤੱਕ ਜਿੰਨੇ ਵੀ ਬੰਦਿਆਂ ਨੂੰ ਮਿਲਿਆ ਕਿ ਇਸ ਗੱਲ ਨੂੰ ਮੈਂ ਪੜ੍ਹੇ ਨੂੰ ਬਹੁਤ ਸਾਰੇ ਸਾਲ ਹੋ ਗਏ ਲਗਭਗ ਵੀਹ ਸਾਲ ਹੋ ਗਏ ਬਟ ਇਹ ਅੱਜ ਵੀ ਇਹ ਫੋਰਮੂਲਾ ਲਾਗੂ ਹੁੰਦਾ ਹੈ ਕਿ ਜੇ ਤੁਸੀਂ ਕਿਸੇ ਗ ਬੰਦੇ ਨੂੰ ਆਪਣੀਆਂ ਗੱਲਾਂ ਦੇ ਵਿੱਚ ਇੰਟਰਸਟ ਬਣਾਉਣਾ ਤਾਂ ਸਭ ਤੋਂ ਪਹਿਲਾਂ ਉਹਦੀ ਆਪਣੀ ਤਾਰੀਫ਼ ਕਰੋ ਉਸਦੀ ਤਾਰੀਫ਼ ਕਰੋਗੇ ਸਰ ਤੁਸੀਂ ਬਹੁਤ ਵਧੀਆ ਲੱਗ ਰਹੇ ਹੋ ਇਹ ਜੈਕਟ ਕਿੱਥੋਂ ਲਈ ਹੈ ਤੁਸੀਂ ਉਹ ਫਿਰ ਆਪਣੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰੂਗਾ ਅਤੇ ਹੌਲੀ ਹੌਲੀ ਉਹਨੂੰ ਵੀ ਇੰਟਰਸਟ ਬਣੇਗਾ ਉਹ ਤੁਹਾਡੇ ਬਾਰੇ ਪੁੱਛਣਾ ਸ਼ੁਰੂ ਕਰੇਗਾ ਜਦੋਂ ਤੁਹਾਡੇ ਬਾਰੇ ਪੁੱਛਣਾ ਸ਼ੁਰੂ ਕਰੇਗਾ ਤੁਸੀਂ ਆਪਣੀ ਗੱਲ ਉਹਨੂੰ ਇੰਟਰਸਟਿੰਗ ਵੇਅ ਦੇ ਨਾਲ ਦੱਸ ਸਕਦੇ ਹੋ ਇਹ ਵਾਕਈ ਸਹੀ ਫੋਰਮੂਲਾ ਸੀ ਜਿਹੜਾ ਕਿ ਇਸ ਕਿਤਾਬ ਦੇ ਵਿੱਚ ਮੈਂ ਪੜ੍ਹਿਆ ਅਤੇ ਅੱਜ ਵੀ ਕਰੀਬ ਕਰੀਬ ਵੀਹ ਸਾਲ ਬਾਅਦ ਵੀ ਉਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਮੈਂ ਲਾਗੂ ਕਰਦਾ ਹਾਂ